ਅੱਜ ਮੈਂ ਤੁਹਾਡੇ ਨਾਲ ਆਪਣੇ ਸਫਰਾਂ ਬਾਰੇ ਗੱਲ ਕਰਨ ਜਾ ਰਿਹਾ ਹਾਂ ਜੋ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਅਲੱਗ ਅਲੱਗ ਥਾਵਾਂ 'ਤੇ ਜਾ ਕੇ ਕੀਤੇ ਮੈਂ ਤੁਹਾਡੇ ਅੱਜ ਮੈਂ ਤੁਹਾਡੇ ਨਾਲ ਅੱਜ ਆਪਣੇ ਮਨਪਸੰਦ ਸਫ਼ਰ ਦੀ ਗੱਲ ਕਰਨ ਜਾ ਰਿਹਾ ਹਾਂ ਜੋ ਕਿ ਮੈਂ ਹੁਸ਼ਿਆਰਪੁਰ ਵਿਖੇ ਜੰਗਲਾਂ ਵਿਖੇ ਕੀਤਾ ਸੀ ਇਸ ਦੇ ਲਈ ਸਭ ਤੋਂ ਪਹਿਲਾਂ ਅਸੀਂ ਇੱਕ ਪਲਾਨਿੰਗ ਕੀਤੀ ਜਿਸ ਦੇ ਵਿੱਚ ਅਸੀਂ ਕੁਝ ਦੋਸਤ ਇਕੱਠੇ ਹੋਏ ਅਤੇ ਅਸੀਂ ਮਿਲ ਕੇ ਹੁਸ਼ਿਆਰਪੁਰ ਦੇ ਜੰਗਲਾਂ ਦੇ ਵਿੱਚ ਜਾਣ ਦਾ ਪਲਾਨ ਕੀਤਾ ਉਸ ਤੋਂ ਬਾਅਦ ਅਸੀਂ ਇੱਕ ਗੱਡੀ ਕਿਰਾਏ 'ਤੇ ਲਈ ਅਤੇ ਉਸ ਵਿੱਚ ਆਪਣਾ ਸਮਾਨ ਵਗੈਰਾ ਪ ਪੈਕ ਕਰਕੇ ਰੱਖ ਲਿਆ ਅਤੇ ਉਸ ਤੋਂ ਬਾਅਦ ਅਸੀਂ ਹੁਸ਼ਿਆਰਪੁਰ ਦੇ ਜੰਗਲਾਂ ਲਈ ਰਵਾਨਾ ਹੋ ਗਏ ਰਸਤੇ ਵਿੱਚ ਅਸੀਂ ਜਲੰਧਰ ਵੀ ਰੁਕੇ ਅਤੇ ਜਲੰਧਰ ਤੋਂ ਹੁੰਦੇ ਹੋਏ ਅਸੀਂ ਹੁਸ਼ਿਆਰਪੁਰ ਵੱਲ ਵੱਧਦੇ ਹੋਏ ਅਲੱਗ ਅਲੱਗ ਥਾਵਾਂ 'ਤੇ ਰੁਕੇ ਅਤੇ ਰ ਰਸਤੇ ਵਿੱਚ ਅਸੀਂ ਖਾਣਾ ਵਗੈਰਾ ਵੀ ਖਾਇਆ ਉਸ ਤੋਂ ਬਾਅਦ ਅਸੀਂ ਅਲੱਗ ਅਲੱਗ ਸਪੋਟ 'ਤੇ ਫੋਟੋਆਂ ਵੀ ਖਿੱਚੀਆਂ ਜੋ ਕਿ ਕਾਫੀ ਯਾਦਗਾਰ ਸਨ ਅਤੇ ਉਸ ਤੋਂ ਬਾਅਦ ਅਸੀਂ ਅਲੱਗ ਉਸ ਤੋਂ ਬਾਅਦ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਰੈਸਟੋਰੈਂਟ ਵਿੱਚ ਜੰਗਲਾਂ ਵਿੱਚ ਪਹੁੰਚਣ ਤੋਂ ਪਹਿਲਾਂ ਪਾਰਟੀ ਵੀ ਕੀਤੀ ਉਸ ਤੋਂ ਬਾਅਦ ਅਸੀਂ ਆਪਣੇ ਫੋਨ ਵਗੈਰਾ ਚਾਰਜ ਕੀਤੇ ਅਤੇ ਫੋਟੋ ਵਗੈਰਾ ਕਰਨ ਲਈ ਇੱਕ ਕੈਮਰੇ ਕੈਮਰਾਮੈਨ ਵੀ ਹਾਇਰ ਕੀਤਾ ਜੋ ਸਾਡੇ ਰਸਤੇ ਵਿੱਚ ਹੋ ਰਹੀਆਂ ਗਤੀਵਿਧੀਆਂ ਨੂੰ ਰਿਕਾਰਡ ਕਰ ਸਕਦਾ ਸੀ ਉਸ ਤੋਂ ਬਾਅਦ ਅਸੀਂ ਜੰਗਲਾਂ ਵਿ ਦੇ ਦਰਮਿਆਨ ਪਹੁੰਚ ਗਏ ਅਤੇ ਹੁਸ਼ਿਆਰ ਆਪਣੀ ਅਸੀਂ ਗੱਡੀ ਪਾਰਕ ਕਰ ਦਿੱਤੀ ਉਸ ਤੋਂ ਬਾਅਦ ਅਸੀਂ ਆਪਣੀ ਫੁੱਲ ਕਿਟ ਦੇ ਨਾਲ ਜੰਗਲਾਂ ਦੇ ਵ ਵੱਲ ਵਧੇ ਜੰਗਲਾਂ ਦੇ ਵਿੱਚ ਅਸੀਂ ਦੇਖਿਆ ਕਿ ਅਲੱਗ ਅਲੱਗ ਜਾਤੀ ਅਲੱਗ ਅਲੱਗ ਜਾਤੀਆਂ ਦੇ ਦਰੱਖਤ ਪਾਏ ਪਾਏ ਗਏ ਜੋ ਕਿ ਆਮ ਪ੍ਰਕਿਰਤੀ ਦੇ ਵਿੱਚ ਦੇਖਣ ਨੂੰ ਨਹੀਂ ਮਿਲਦੇ ਜੰਗਲਾਂ ਦੇ ਵਿੱਚ ਬਹੁਤ ਹੀ ਸ਼ਾਂਤ ਮਾਹੌਲ ਸੀ ਉੱਥੇ ਕੋਈ ਵੀ ਸ਼ੋਰ ਵ ਸ਼ੋਰ ਵਗੈਰਾ ਨਹੀਂ ਸੀ ਅਤੇ ਹਵਾ ਵੀ ਬਹੁਤ ਹੀ ਸ਼ੁੱਧ ਸੀ ਜਿੱਥੇ ਕੋਈ ਵੀ ਏਸੀ ਵਗੈਰਾ ਦੀ ਜ਼ਰੂਰਤ ਨਹੀਂ ਸੀ ਕਿਉਂਕਿ ਜੰਗਲਾਂ ਦੇ ਵਿੱਚ ਮਾਹੌਲ ਇੰਨਾਂ ਠੰਡਾ ਹੈ ਇੱਥੇ ਉੱਥੇ ਜਾ ਕੇ ਪਤਾ ਲੱਗਦਾ ਹੈ ਕਿ ਦਰੱਖਤਾਂ ਦੀ ਮਹੱਤਤਾ ਕੀ ਹੈ ਜੰਗਲਾਂ ਦੇ ਵਿੱਚ ਅਸੀਂ ਹਾਈਕਿੰਗ ਵੀ ਕੀਤੀ ਉਸ ਤੋਂ ਬਾਅਦ ਅਸੀਂ ਜੰਗਲਾਂ ਦੇ ਵਿੱਚ ਜਾ ਕੇ ਟਰੈਕਿੰਗ ਕੀਤੀ ਕਾਫੀ ਕੁਝ ਜੰਗਲਾਂ ਦੇ ਵਿੱਚ ਸਾਨੂੰ ਕਾਫੀ ਕੁਝ ਦੇਖਣ ਨੂੰ ਮਿਲਿਆ ਅਤੇ ਸਿੱਖਣ ਨੂੰ ਵੀ ਮਿਲਿਆ ਅ ਕਿਸ ਤਰ੍ਹਾਂ ਅਸੀਂ ਜੰਗਲਾਂ ਦੇ ਵਿੱਚ ਸਰਵਾਈਵ ਕਰ ਸਕਦੇ ਹਾਂ ਉਸ ਤੋਂ ਬਾਅਦ ਅਸੀਂ ਜੰਗਲਾਂ ਦੇ ਵਿੱਚ ਹੀ ਆਪਣਾ ਸਮਾਨ ਖਾਣ ਪੀਣ ਦਾ ਸਮਾਨ ਖੋਲ੍ਹ ਲਿਆ ਅਤੇ ਉੱਥੇ ਬਹਿ ਕੇ ਅਸੀਂ ਇੱਕ ਵਧੀਆ ਪਾਰਟੀ ਕੀਤੀ ਅਤੇ ਫੋਟੋਆਂ ਵਗੈਰਾ ਕੀਤੀਆਂ ਇ ਇਸ ਤੋਂ ਬਾਅਦ ਅਸੀਂ ਜੰਗਲਾਂ ਦੇ ਵਿੱਚ ਇੱਕ ਨ ਨਦੀ ਦੇਖੀ ਜਿਸ ਦੇ ਵਿੱਚ ਅਸੀਂ ਬੋਟਿੰਗ ਵਗੈਰਾ ਵੀ ਕੀਤੀ ਜਿਸ ਦੇ ਨਾਲ ਸਾਨੂੰ ਕਾਫੀ ਆਨੰਦ ਆਇਆ ਅਤੇ ਉਸ ਤੋਂ ਬਾਅਦ ਅਸੀਂ ਆਪਣੇ ਰੈਸਟ ਹਾਊਸ ਦੇ ਲਈ ਰਵਾਨਾ ਹੋ ਗਏ ਜਿੱਥੇ ਜਾ ਕੇ ਅਸੀਂ ਜੰਗਲਾਂ ਦੇ ਵਿੱਚ ਜੋ ਵੀ ਕੁਝ ਨੋਟ ਕੀਤਾ ਸੀ ਉਸ ਨੂੰ ਸਾਰਾ ਆਪਣੀ ਕਾਪੀ ਪੈਨ 'ਤੇ ਨੋਟ ਕੀਤਾ ਸਾਡਾ ਸਫਰ ਬਹੁਤ ਹੀ ਵਧੀਆ ਰਿਹਾ